ਫੇਸਬੁੱਕ ਅਤੇ ਇੰਨਸਟਾਗ੍ਰਾਮ 'ਤੇ ਵੀ ਬਹੁਤ ਸਾਰੀਆਂ ਖ਼ਬਰਾਂ ਸਾਨੂੰ ਅੱਪਡੇਟ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਕਿ ਮੇਰੇ ਭਰਾ ਦਾ ਵੀ ਫੇਸਬੁੱਕ ਅਤੇ ਇੰਨਸਟਾਗ੍ਰਾਮ 'ਤੇ ਅਕਾਊਂਟ ਹੈ ਕਿ ਜੋ ਸਾਨੂੰ ਦੇਸ਼ ਦੀ ਹਰੇਕ ਖ਼ਬਰ ਪਤਾ ਚੱਲ ਜਾਂਦੀ ਹੈ ਜਿਵੇਂ ਕਿ ਸੜਕ ਹਾਦਸੇ ਦੁਰਘਟਨਾ ਉਹ ਵੀ ਸਾਨੂੰ ਫੇਸਬੁੱਕ ਅਤੇ ਇੰਨਸਟਾਗ੍ਰਾਮ 'ਤੇ ਪਤਾ ਚੱਲ ਜਾਂਦੀਆਂ ਇੰਨਸਟਾ ਫੇਸਬੁੱਕ 'ਤੇ ਸਾਨੂੰ ਹਰੇਕ ਜ਼ਿਲ੍ਹੇ ਦੀ ਖ਼ਬਰ ਪਤਾ ਲੱਗ ਜਾਂਦੀ ਹੈ ਅਤੇ ਸਾਨੂੰ ਹਰੇਕ ਜ਼ਿਲ੍ਹੇ ਦੀ ਖ਼ਬਰ ਪਤਾ ਲੱਗ ਜਾਂਦੀ ਹੈ ਅਤੇ ਸਾਨੂੰ ਹਰੇਕ ਤਰ੍ਹਾਂ ਦੀ ਨੌਲੇਜ ਜੀ ਕੇ ਨੌਲੇਜ ਦੇ ਕੌਸ਼ਨ ਵੀ ਪਤਾ ਲੱਗ ਜਾਂਦੇ ਹਨ ਕਿ ਕੀ ਭਾਰਤ ਸਰਕਾਰ ਦੁਆਰਾ ਸਭ ਪਤਾ ਚੱਲ ਜਾਂਦਾ ਹੈ ਜਿਵੇਂ ਕਿ ਸਾਡੇ ਦੇਸ਼ ਵਿੱਚ ਕੀ ਕੀ ਹੋ ਰਿਹਾ ਹੈ ਕਿਹੜਾ ਗੀਤ ਕਿੰਨਵੇਂ ਨੰਬਰ 'ਤੇ ਹੈ ਕੋ ਕ ਕਿਹੜਾ ਸਿੰਗਰ ਕਿੰਨਵੇਂ ਨੰਬਰ 'ਤੇ ਜਾ ਰਿਹਾ ਹੈ ਕਿੱਥੇ ਕੁਛ ਹੋ ਰਿਹਾ ਹੈ ਸਭ ਪਤਾ ਚੱਲ ਜਾਂਦਾ ਹੈ ਫੇਸਬੁੱਕ 'ਤੇ ਫੇਸਬੁੱਕ ਅੱਪਡੇਟ ਬਹੁਤ ਹੀ ਵਧੀਆ ਐਪ ਹੈ ਅਤੇ ਇਸ ਨੂੰ ਮੇਰਾ ਭਰਾ ਵੀ ਚਲਾਉਂਦਾ ਹੈ ਅਤੇ ਇਸ 'ਤੇ ਮੇਰਾ ਅਕਾਊਂਟ ਵੀ ਹੈ ਬਹੁਤ ਵਧੀਆ ਫੇਸਬੁੱਕ ਐਪ ਹੈ ਅਤੇ ਇਸ ਕਾਰਨ ਸਾਨੂੰ ਹਰੇਕ ਜੀ ਕੇ ਨੌਲੇਜ ਦੀ ਕੌਸ਼ਨ ਬਿਲਕੁੱਲ ਸ ਅਸਾਨੀ ਨਾਲ ਪਤਾ ਲੱਗ ਜਾਂਦੇ ਹਨ ਅਤੇ ਸਾਰੇ ਪਿੰਡਾਂ ਸ਼ਹਿਰਾਂ ਜ਼ਿਲ੍ਹਿਆਂ ਦੀ ਸਭ ਖ਼ਬਰ ਪਤਾ ਲੱਗ ਜਾਂਦੀ ਹੈ ਫੇਸਬੁੱਕ 'ਤੇ ਕਿ ਕਿਹੜੀ ਸੜਕ ਬਣ ਰਹੀ ਹੈ ਅਤੇ ਕਿਆ ਪ ਭਾਰਤ ਸਰਕਾਰ ਵਿੱਚ ਕਿਆ ਕਿਆ ਹੋ ਰਿਹਾ ਹੈ ਇਹ ਸਾਰਾ ਸਾਨੂੰ ਫੇਸਬੁੱਕ 'ਤੇ ਪਤਾ ਲੱਗ ਜਾਂਦਾ ਹੈ